ਸਾਡੇ ਪਰਿਵਾਰ ਵਿੱਚ ਦੀਵਾਲੀ ਦਾ ਤਿਉਹਾਰ ਬਹੁਤ ਵਧੀਆ ਢੰਗ ਨਾਲ ਮਨਾਇਆ ਜਾਂਦਾ ਹੈਗਾ ਹੈ ਇਸ ਦੀਵਾਲੀ ਤੋਂ ਦੀਵਾਲੀ ਦੀ ਤਾਂ ਪਹਿਲਾਂ ਹੀ ਬਹੁਤ ਖੁਸ਼ੀ ਹੁੰਦੀ ਹੈਗੀ ਹੈ ਸਾਰਿਆਂ ਨੂੰ ਆਉਣ ਦੀ ਕਿਉਂਕਿ ਇਸ ਤੋਂ ਹਫਤਾ ਪਹਿਲਾਂ ਹੀ ਹਫਤਾ ਪਹਿਲਾਂ ਘਰ ਦੇ ਵਿੱਚ ਸਾਫ ਸਫਾਈਆਂ ਅਤੇ ਹਫ ਬ ਦੀਵਾਲੀ ਦੀਆਂ ਤਿਆਰੀਆਂ ਸਾਰੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਜਦੋਂ ਦੀਵਾਲੀ ਦਾ ਤਿਉਹਾਰ ਆਉਂਦਾ ਹੈਗਾ ਹੈ ਤਾਂ ਉਸ ਦਿਨ ਖਾਣ ਪੀਣ ਨੂੰ ਵਧੀਆ ਚੀਜ਼ਾਂ ਮਿਲਦੀਆਂ ਹੈਗੀਆਂ ਹੈ ਉਹਦੇ ਨਾਲ ਨਾਲ ਇਹਦਾ ਕੁਛ ਬੈਕਗਰਾਊਂਡ 'ਤੇ ਕਾਫੀ ਇਤਿਹਾਸ ਵੀ ਹੈਗਾ ਜਿੱਦਾਂ ਆਪਾਂ ਸਿੱਖ ਹਿਸਟਰੀ ਵੱਲ ਝਾਤੀ ਮਾਰ ਕੇ ਦੇਖੀਏ ਤਾਂ ਇਸ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਜੋ ਕਿ ਸਿੱਖਾਂ ਦੇ ਛੇਵੇਂ ਗੁਰੂ ਹੋਏ ਹੈਗੇ ਹੈ ਉਹਨਾਂ ਨੇ ਗਵਾਲੀਅਰ ਦੇ ਕਿਲੇ 'ਚੋਂ ਜਹਾਂਗੀਰ ਦੀ ਕੈਦ 'ਚੋਂ ਬਵੰਜਾ ਰਾਜੇ ਆਪਣੇ ਨਾਲ ਕੈਦ ਤੋਂ ਬਾਹਰ ਕਢਵਾਏ ਜੇ ਆਪਾਂ ਹਿੰਦੂ ਰਲੀਜਨ ਵੱਲ ਨਿਗਾਹ ਮਾਰ ਕੇ ਦੇਖੀ ਜਾਵੇ ਤਾਂ ਹਿੰਦੂ ਰਲੀਜਨ ਵੱਲ਼ ਇਸ ਦਿਨ ਸ਼੍ਰੀ ਰਾਮ ਚੰਦਰ ਜੀ ਅਯੁਧਿਆ ਪਰਤੇ ਸੀਗੇ ਅਤੇ ਉਹਨਾਂ ਨੇ ਉਨ੍ਹਾਂ ਲਈ ਉੱਥੇ ਆਉਣ ਦੀ ਖੁਸ਼ੀ ਵਿੱਚ ਉੱਥੇ ਦੀਪਮਾਲਾ ਕੀਤੀ ਜਾਂਦੀ ਸੀਗੀ ਇਸ ਦਿਨ ਸ਼ਾਮ ਨੂੰ ਮੱਥਾ ਟੇਕਣ ਤੋਂ ਬਾਅਦ ਉਹਦੇ ਬਾਅਦ ਪਟਾਕੇ ਚਲਾਏ ਜਾਂਦੇ ਹੈਗੇ ਹੈ ਫਰੂਟਸ ਵਗੈਰਾ ਖਾਧੇ ਜਾਂਦੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਧੇ ਜਾਂਦੇ ਹੈਗੇ ਹੈ